ਪੰਜਾਬ ਵਿੱਚ ਸਿੱਖਿਆ ਪ੍ਰਣਾਲੀਆਂ ਦੇ ਅਧਿਆਪਕਾਂ ਦੀ ਘਾਟ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਅਧਿਆਪਕਾਂ ਨੂੰ ਥੋੜ੍ਹੀ ਜ਼ਿਆਦਾ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਕਈ ਕੁੜੀਆਂ ਨੇ ਜਾਂ ਫਿਰ ਕਈ ਅਧਿਆਪਕਾਂ ਨੇ ਸਿਰਫ ਪਲੱਸ ਟੂ ਹੀ ਕੀਤੀ ਹੁੰਦੀ ਹੈ ਅਤੇ ਉਹਨਾਂ ਨੂੰ ਵੱਡੇ ਬੱਚਿਆਂ ਨੂੰ ਪੜ੍ਹਾਉਣ ਲਗਾ ਦਿੱਤਾ ਜਾਂਦਾ ਹੈ ਜਿਹਦੇ ਨਾਲ ਨਾ ਤਾਂ ਵੱਡੇ ਬੱਚਿਆਂ ਨੂੰ ਕੁਛ ਸਮਝ ਆਉਂਦਾ ਹੈ ਅਤੇ ਨਾ ਹੀ ਉਹਨਾਂ ਨੂੰ ਕੁਛ ਪੜ੍ਹਾਉਣਾ ਆਉਂਦਾ ਹੈ ਅਤੇ ਵੱਡੇ ਬੱਚੇ ਜਿਹੜੇ ਹੁੰਦੇ ਹਨ ਉਹਨਾਂ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਕਿਉਂਕਿ ਘਰ ਆ ਕੇ ਫਿਰ ਉਹ ਆਪਣੇ ਮਾਂ ਬਾਪ ਨੂੰ ਕਹਿੰਦੇ ਹਨ ਕਿ ਸਾਨੂੰ ਟਿਊਸ਼ਨਾਂ ਲਗਵਾਓ ਕਿਉਂਕਿ ਉਹਨਾਂ ਨੂੰ ਸਕੂਲ ਵਿੱਚ ਕੁਛ ਨਹੀਂ ਸਮਝ ਆਉਂਦਾ ਅਤੇ ਜਦੋਂ ਅਧਿ ਜਦੋਂ ਅਧਿਆਪਕ ਇੱਦਾਂ ਦੇ ਹੋਣਗੇ ਤਾਂ ਬੱਚੇ ਕੀ ਕਰਨਗੇ ਕਿਉਂਕਿ ਉਹਨਾਂ ਨੂੰ ਜਾਂ ਤਾਂ ਪੇਆਂ ਘੱਟ ਦਿੱਤੀਆਂ ਜਾਂਦੀਆਂ ਹਨ ਜਾਂ ਫਿਰ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਹੀ ਨਹੀਂ ਆਉਂਦਾ ਕਿਉਂਕਿ ਅੱਜ ਕੱਲ੍ਹ ਸਕੂਲਾਂ ਕੋਲਜਾਂ ਵਿੱਚ ਜੋ ਟੀਚਰ ਹੁੰਦੇ ਹਨ ਉਹਨਾਂ ਨੂੰ ਛੋਟੀ ਕੁਆਲੀਫਿਕੇਸ਼ਨ 'ਤੇ ਵੀ ਰੱਖ ਲਿੱਤਾ ਜਾਂਦਾ ਹੈ ਕਿਉਂਕਿ ਸਕੂਲ ਵਾਲਿਆਂ ਕੋਲ ਹੀ ਪੈਸਾ ਨਹੀਂ ਹੁੰਦਾ ਜੋ ਉਹ ਉਹਨਾਂ ਨੂੰ ਦੇ ਸਕਣ ਅਤੇ ਕਈ ਵਾਰੀ ਤਾਂ ਇੱਦਾਂ ਹੁੰਦਾ ਹੈ ਕਿ ਇੱਕ ਕਲਾਸ ਵਿੱਚ ਸੌ ਸੌ ਦੋ ਸੌ ਦੋ ਸੌ ਬੱਚੇ ਹੁੰਦੇ ਹਨ ਅਤੇ ਟੀਚਰ ਇੱਕ ਹੀ ਹੁੰਦੀ ਹੈ ਅਤੇ ਇਹ ਹਿਸਾਬ ਨਾਲ ਤੁਸੀਂ ਹੀ ਜਾਣਦੇ ਹੋ ਕਿ ਕਿੰਨਾ ਕੁ ਪੜ੍ਹਾ ਸਕਦੀ ਹੈ ਇੱਕ ਟੀਚਰ